ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਸ ਕੁਛ ਨਹੀਂ ਤੁਹਾਨੂੰ ਪਤਾ ਬੱਚਿਆਂ ਦੇ ਐਡਮਿਸ਼ਨ ਦਾ ਟਾਈਮ ਆ ਤਾਂ ਉਹੀ ਕੰਮ ਲੱਗੇ ਹੋਏ ਹਾਂ ਅੱਛਾ ਜੀ ਠੀਕ ਹੈ ਜੀ ਠੀਕ ਠੀਕ ਠੀਕ ਅੱਛਾ ਅਤੇ ਹੁਣ ਫਿਫਥ 'ਚ ਹੋਣਾ ਬੱਚਿਆਂ ਨੇ ਛਾ ਅੱਛ ਅੱਛਾ ਕੇ ਵੀ 'ਚ ਪੜ੍ਹਦੇ ਆ ਠੀਕ ਹੈ ਜੀ ਅਤੇ ਭਾਅ ਜੀ ਯਾਰ ਆਪਣੇ ਤਾਂ ਸਿਟੀ ਦੇ ਵਿੱਚ ਹੈਗੇ ਦੋ ਤਿੰਨ ਸਕੂਲ ਹੈਗੇ ਵਧੀਆ ਹੈ ਨਾ ਅਤੇ ਬਾਕੀ ਜੇ ਤੁਸੀਂ ਕਹਿੰਦੇ ਕਿ ਮੈਂ ਕੇ ਵੀ 'ਚ ਹੀ ਪਾਉਣਾ ਵਾ ਫਿਰ ਤਾਂ ਥੋੜ੍ਹਾ ਦੂਰ ਹੈਗਾ ਕ ਆਊਟ ਓਫ ਦਾ ਕਹਿ ਲਓ ਥੋੜ੍ਹਾ ਪ੍ਰਾਇਵੇਟ ਸਰ ਤੁਸੀਂ ਐਮ ਜੀ ਐਮ ਪਾ ਦਿਓ ਸਿਟੀ ਦੇ ਵਿੱਚ ਹੈ ਉੱਥੇ ਆਉਣਾ ਜਾਣਾ ਵੀ ਸੌਖਾ ਵਾ ਅਤੇ ਪੜ੍ਹਾਈ ਪੱਖੋਂ ਵੀ ਬਹੁਤ ਵਧੀਆ ਵਾ ਹੈ ਨਾ ਅਤੇ ਉੱਥੇ ਐਕਟੀਵਿਟੀ ਬਹੁਤ ਨੇ ਬੱਚਿਆਂ ਦੀ ਜਿਹੜੀ ਕਿ ਕਹਿ ਲਓ ਹੁਣ ਤਾਂ ਸਵੀਮਿੰਗ ਹੋ ਰਹੀ ਹੈ ਬਾਸਕਿਟ ਬੋਲ ਫੁੱਟਬੋਲ ਕਰਾਟੇ ਅਤੇ ਮਿਊਜ਼ਕ ਹੋ ਗਿਆ ਡਾਂਸ ਮਤਲਬ ਹਰ ਤਰ੍ਹਾਂ ਦੀ ਐਕਟੀਵਿਟੀ ਉੱਥੇ ਕਰਾਉਂਦੇ ਆ ਦੂਜੀ ਗੱਲ ਇਹ ਕਿ ਸਰ ਮਤਲਬ ਨਾ ਉੱਥੇ ਕਰਾਊਡ ਬਹੁਤ ਅੱਛਾ ਹੈ ਸਿਟੀ ਦਾ ਕਰਾਊਡ ਹੈ ਤੋ ਬੱਚੇ ਬਹੁਤ ਡਿਸਿਪਲਨ ਨੇ ਟੀਚਰ ਬਹੁਤ ਮਤਲਬ ਕੁਆਲੀਫਾਈ ਵਧੀਆ ਟੀਚਰ ਨੇ ਉੱਥੇ ਅਤੇ ਮੇਰੇ ਹਿਸਾਬ ਨਾਲ ਤੁਸੀਂ ਐੱਮ ਜੀ ਐਨ ਨੂੰ ਫਸਟ ਪ੍ਰੈਫਰੈਂਸ ਲੈ ਕੇ ਚੱਲੋ ਉਸ ਤੋਂ ਬਾਅਦ ਤੁਸੀਂ ਕੈਮਰਿਜ ਦਾ ਵੀ ਸੋਚ ਸਕਦੇ ਹੋ ਕੈਮਰਿਜ ਵੀ ਅੱਛਾ ਸਕੂਲ ਹੈ ਦੂਜੇ ਨੰਬਰ 'ਤੇ ਤੁਸੀਂ ਲੈ ਕੇ ਚੱਲੋ ਤੀਜੇ ਨੰਬਰ ਤੁਸੀਂ ਬਾਵਾ ਲਾ ਲੈ ਕੇ ਚੱਲੋ ਅਤੇ ਇੱਦਾਂ ਹੀ ਹੋਰ ਵੀ ਸਾਡੇ ਸ਼ਹਿਰ ਸ਼ਹਿਰ 'ਚ ਵਾਧੂ ਸਕੂਲ ਆ ਤੁਸੀਂ ਆਓ ਪਹਿਲਾਂ ਆਉਣ ਤੋਂ ਬਾਅਦ ਨਾ ਤੁਸੀਂ ਸਲਾਹ ਕਰ ਲਓ ਫੈਮਲੀ ਨਾਲ ਜਿੱਥੇ ਤੁਹਾਨੂੰ ਸੂਟੇਬਲ ਹੋਏਗਾ ਉੱਥੇ ਪਾ ਦੇਵਾਂਗੇ ਬੱਚੇ ਹੈ ਨਾ ਠੀਕ ਹੈ ਠੀਕ ਆਓ ਜੀ ਆਓ ਓਕੇ ਜੀ ਓਕੇ ਓਕੇ